ਸਤਿ ਸ਼੍ਰੀ ਅਕਾਲ ਮੇਰਾ ਨਾਮ ਸੁਨਿਧੀ ਹੈ ਔਰ ਮੈਂ ਪੰਜਾਬ ਦੀ ਰਹਿਣ ਵਾਲੀ ਹਾਂ ਔਰ ਮੈਂ ਗੁਰਦਾਸਪੁਰ ਸ਼ਹਿਰ ਵਿੱਚ ਰਹਿੰਦੀ ਹਾਂ ਔਰ ਅ ਅਕਸਰ ਆਪਣੇ ਨੇੜਲੇ ਪਿੰਡਾਂ ਵਿੱਚ ਘੁੰਮਣ ਲਈ ਜਾਂਦੇ ਹਾਂ ਆਪਣੇ ਪਰਿਵਾਰ ਦੇ ਨਾਲ ਔਰ ਆਪਣੇ ਦੋਸਤਾਂ ਦੇ ਨਾਲ ਮੈਨੂੰ ਪਿੰਡਾਂ ਦਾ ਵਾਤਾਵਰਨ ਬਹੁਤ ਹੀ ਵਧੀਆ ਲੱਗਦਾ ਹੈ ਜਿਹਦੇ ਕਰਕੇ ਕਿ ਓਥੇ ਜਾਣਾ ਬਹੁਤ ਪਸੰਦ ਹੈ ਔਰ ਸ਼ਹਿਰਾਂ ਵਿੱਚ ਉਹ ਸਭ ਕੁਛ ਦੇਖਣ ਲਈ ਨਹੀਂ ਮਿਲਦਾ ਹੈ ਵੈਸੇ ਤਾਂ ਕਿ ਪਿੰਡਾਂ ਦੇ ਵਾਤਾਵਰਨ ਵਿੱਚ ਤਾਜ਼ਗੀ ਹੁੰਦੀ ਹੈ ਹਵਾ ਵਿੱਚ ਸਫ਼ਾਈ ਹੁੰਦੀ ਹੈ ਸ਼ਹਿਰਾਂ ਵਿੱਚ ਫੈਕਟਰੀਆਂ ਵਗੈਰਾ ਹੋਣ ਦੇ ਕਾਰਨ ਵਾਤਾਵਰਨ ਪਲਿਊਟਡ ਹੋ ਜਾਂਦਾ ਹੈ ਜਿਹੜਾ ਕਿ ਸਾਡੀ ਸਿਹਤ ਵਿੱਚ ਵੀ ਕੋਈ ਨਾ ਕੋਈ ਸਾਈਡ ਇਫੈਕਟ ਪਾਉਂਦਾ ਹੀ ਹੈ ਔਰ ਪਿੰਡਾਂ ਵਿੱਚ ਮਾਹੌਲ ਬਹੁਤ ਹੀ ਵਧੀਆ ਹੁੰਦਾ ਹੈ ਲੋਕ ਮਿਲ ਜੁਲ ਕੇ ਰਹਿੰਦੇ ਹਨ ਸ਼ਹਿਰਾਂ ਵਿੱਚ ਸਾਰੇ ਲੋਕ ਆਪਣੇ ਆਪਣੇ ਘਰਾਂ ਵਿੱਚ ਆਪਣੇ ਆਪਣੇ ਕੰਮਾਂ ਵਿੱਚ ਵਿਅਸਤ ਰਹਿੰਦੇ ਹਨ ਜਿਹਦੇ ਕਰਕੇ ਕਿ ਇੱਕ ਦੂਸਰੇ ਨੂੰ ਮਿਲਣ ਵਰਤਣ ਦਾ ਸਮਾਂ ਵੀ ਬਹੁਤ ਘੱਟ ਮਿਲਦਾ ਹੈ ਔਰ ਪਿੰਡਾਂ ਵਿੱਚ ਲੋਕ ਮਿਲ ਜੁਲ ਕੇ ਇੱਕ ਦੂਸਰੇ ਦੇ ਕਰੀਬ ਰਹਿੰਦੇ ਹਨ ਦਿਲ ਦੇ ਸਾਫ਼ ਲੋਕ ਪਿੰਡਾਂ ਵਿੱਚ ਬਹੁਤ ਹੀ ਦੇਖਣ ਨੂੰ ਮਿਲਦੇ ਹਨ ਜਿੱਦਾਂ ਕਿ ਅਸੀਂ ਪਿੰਡਾਂ ਵਿੱਚ ਔਰਤਾਂ ਨੂੰ ਅਕਸਰ ਇਕੱਠੇ ਬੈਠ ਕੇ ਸਿਲਾਈ ਬੁਣਾਈ ਕਰਦੇ ਦੇਖਦੇ ਹਾਂ ਉਹ ਟੋਟੇ ਕਰਦੀਆਂ ਨੇ ਕੱਪੜੇ ਬਣਾਉਂਦੀਆਂ ਨੇ ਆਪਣੇ ਸੂਟ ਬਣਾਉਂਦੀਆਂ ਐ ਆਪਣੀ ਸਹੇਲੀਆਂ ਭੈਣਾਂ ਦੇ ਸੂਟ ਬਣਾਉਂਦੀਆਂ ਇਕੱਠੇ ਬਹਿ ਕੇ ਹੱਸਦੀਆਂ ਖੇਡਦੀਆਂ ਨੇ ਲੋਕ ਪਿੰਡਾਂ ਦੀਆਂ ਕੁੜੀਆਂ ਤਿਉਹਾਰ ਮਨਾਉਂਦੀਆਂ ਨੇ ਕਕ ਕਵਾਰੀਆਂ ਕੁੜੀਆਂ ਇੱਕ ਦੂਸਰੇ ਨਾਲ ਗੱਲਾਂ ਕਰਦੀਆਂ ਨੇ ਗਿੱਧਾ ਪਾਉਂਦੀਆਂ ਨੇ ਸ਼ਹਿਰਾਂ ਵਿੱਚ ਕੁੜੀਆਂ ਪੜ੍ਹਾਈ 'ਤੇ ਵਿਅਸਤ ਰਹਿੰਦੀਆਂ ਹੈ ਇੱਕ ਦੂਸਰੇ ਨਾਲ ਬੋਲਚਾਲ ਵੀ ਘੱਟ ਹੁੰਦਾ ਹੈ ਆਦਮੀ ਕੰਮਾਂ 'ਤੇ ਰਹਿੰਦੇ ਹਨ ਪਿੰਡਾਂ ਵਿੱਚ ਖੇਤੀਬਾੜੀ ਦੇ ਕਰਕੇ ਬਹੁਤ ਹੀ ਵਧੀਆ ਮਾਹੌਲ ਰਹਿੰਦਾ ਹੈ ਔਰ ਲੋਕ ਇੱਕ ਦੂਸਰੇ ਨਾਲ ਮਿਲਦੇ ਰਹਿੰਦੇ ਹਨ ਜਿਹਦੇ ਕਰਕੇ ਕਿ ਵਾਤਾਵਰਨ ਬਹੁਤ ਹੀ ਵਧੀਆ ਅਤੇ ਮਿਲਣਸਾਰ ਹੁੰਦਾ ਹੈ